ਸਾਡੇ ਇੱਥੇ ਖਿੱਤੇ ਵਿੱਚ ਵੱਖ ਵੱਖ ਧਰਮਾਂ 'ਤੇ ਭਾਈਚਾਰੇ ਦੇ ਲੋਕ ਰਹਿੰਦੇ ਹਨ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਰੱ ਵਿੱਚ ਰੱਖਦੇ ਹੋਏ ਨਿਊਜ਼ ਜਿਹੜੇ ਮੀਡੀਆ ਨਿਊਜ਼ ਕਵਰਨ ਵੇਲੇ ਇਸ ਗੱਲ ਦਾ ਬੜਾ ਹੀ ਧਿਆਨ ਰੱਖਣਾ ਪੈਂਦਾ ਹੈ ਅਤੇ ਰੱਖਿਆ ਵੀ ਜਾਂਦਾ ਹੈ ਜਦੋਂ ਵੀ ਕਿਉਂਕਿ ਤ ਸਾਡੇ ਖਿੱਤੇ ਦੇ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਇਸ ਕਰਕੇ ਵੱਖ ਵੱਖ ਧਰਮਾਂ ਦੇ ਲੋਕਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਭਾਵਨਾਵਾਂ ਸੰਵੇਦਨਸ਼ੀਲਤਾਂ ਹੁੰਦੀਆਂ ਨੇ ਅਤੇ ਧਾਰਮਿਕ ਖਬਰਾਂ ਜਾਂ ਧਾਰਮਿਕ ਭਾਈਚਾਰੇ ਦੀ ਜਦੋਂ ਵੀ ਕੋਈ ਨਿਊਜ਼ ਹੁੰਦੀ ਹੈ ਉਸ ਨੂੰ ਕਵਰਜ ਕਰਨ ਲੱਗੇ ਇਹ ਪੱਖਾਂ ਨੂੰ ਧਿਆਨ ਨਾਲ ਵਿਚਾਰਨਾ ਪੈਂਦਾ ਹੈ ਵੀ ਕਿਸੇ ਦੇ ਦਿਲ ਨੂੰ ਹਰਟ ਨਾ ਹੋਵੇ ਇਸ ਕਰਕੇ ਨਿਊਜ਼ ਮੀਡੀਏ ਦਾ ਹੋਰ ਵੀ ਜਿਹੜਾ ਬੜੀ ਸੰਵੇਦਨਸ਼ੀਲਤਾ ਦੇ ਨਾਲ ਇਹ ਜਿੰਮੇਵਾਰੀ ਵੀ ਬਣ ਜਾਂਦੀ ਐ ਕਿ ਜਿਹੜੀ ਖ਼ਬਰ ਨੂੰ ਹੈ ਨਿਰਪੱਖ ਅਤੇ ਧਾਰਮਿਕ ਨਿਰਪੱਖਤਾ ਦੇ ਤੌਰ 'ਤੇ ਦਿਖਾਇਆ ਜਾਵੇ ਇਸ ਕਰਕੇ ਮੀਡੀਏ ਦੇ ਜਿੱਥੇ ਜਿੰਮੇਵਾਰੀ ਹੁੰਦੀ ਹੈ ਉੱਥੇ ਉਹਨਾਂ ਦਾ ਫਰਜ਼ ਵੀ ਬਣਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੀ ਆ ਜਦੋਂ ਵੀ ਅ ਨਿਊਜ਼ ਮੀਡੀਏ ਨੇ ਖ਼ਬਰ ਦਿਖਾਉਣੀ ਹੁੰਦੀ ਹੈ ਤਾਂ ਇਹਨਾਂ ਪੱਖਾਂ ਨੂੰ ਸੰਵੇਦਨਸ਼ੀਲਤਾ ਨੂੰ ਧਿਆਨ ਰੱਖਿਆ ਜਾਂਦਾ ਹੈ